ਸਾਡੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਹੈ ਇਹ ਭੰਗੜਾ ਆਮ ਤੌਰ 'ਤੇ ਖੁਸ਼ੀ ਦੇ ਮੌਕੇ 'ਤੇ ਜਾਂ ਹੋਰ ਵੀ ਕਈ ਸੰਸਥਾਵਾਂ 'ਤੇ ਕਿਸੇ ਜਰਨਲ ਐਕਟੀਵਿਟੀ ਕੋਲਜਾਂ ਵਿੱਚ ਪਾਇਆ ਜਾਂਦਾ ਹੈ ਇਸ ਭੰਗੜੇ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਪਾਇਆ ਜਾਂਦਾ ਹੈ ਉਹਦੇ ਵਿੱਚ ਕੁਝ ਸਾਰੇ ਸਟੈਪ ਹਨ ਜਿਵੇਂ ਕਿ ਬੇੜੀ ਸਿੰਗਲ ਧਮਾਲ ਸਿੰਗਲ ਝੁੰਮਰ ਚਾਲ ਸ਼ੀਸ਼ਾ ਪੰਜਾਬ ਜੁਗਨੀ ਠੁਮਕਾ ਲੁੱਡੀ ਸਾਡੀ ਤਾਰੀ ਹੋਰ ਵੀ ਕਾਫੀ ਸਾਰੇ ਸਟੈਪ ਹਨ ਇਹ ਸਟੈਪਾਂ ਨਾਲ ਸਾਡੇ ਪੰਜਾਬ ਵਿੱਚ ਭੰਗੜੇ ਦੀ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ ਇਹ ਪੰਜਾਬ ਦੇ ਸੱਭਿਆਚਾਰ ਨੂੰ ਹੋਰ ਵੀ ਅੱਗੇ ਵਧਾ ਰਹੇ ਹਨ ਪੰਜਾਬ ਵਿੱਚ ਜੋ ਭੰਗੜਾ ਪਾਇਆ ਜਾਂਦਾ ਉਹ ਹੁਣ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਪਾਇਆ ਜਾਂਦਾ ਹੈ ਇਸ ਨਾਲ ਜਸ਼ਨ ਦਾ ਜੋ ਮਾਹੌਲ ਹੁੰਦਾ ਹੈ ਉਹ ਵੀ ਵਧੀਆ ਬਣ ਜਾਂਦਾ ਹੈ ਜਿਸ ਨਾਲ ਜੋ ਵੀ ਲੋਕ ਇਸ ਜਸ਼ਨ ਦੇ ਵਿੱਚ ਸ਼ਾਮਿਲ ਹੁੰਦੇ ਹਨ ਉਹ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹੁੰਦੇ ਹਨ ਉਹਨਾਂ ਨੂੰ ਐ ਮਨੋਰੰਜਨ ਵਜੋਂ ਵਧੀਆ ਲੱਗਦਾ ਹੈ